ਗੱਤਕੇ ਨੇ ਆਪਣੀ ਰਵਾਇਤੀ ਸੰਦਰਭ ਤੋਂ ਬਾਹਰ ਪ੍ਰਸਿੱਧ ਪਰਾ ਸੱਭਿਆਚਾਰ ਕਲਾ ਨੂੰ ਪ੍ਰਭਾਵਿਤ ਕੀਤਾ ਹੈ ਗੱਤਕੇ ਗੱਤਕੇ ਨੂੰ ਸ਼ਹੀਦੀ ਪੁਰਬ 'ਤੇ ਜਨਮ ਦਿਹਾੜੇ 'ਤੇ ਆਮ ਖੇਡਿਆ ਜਾਂਦਾ ਹੈ ਗੱਤਕੇ ਨੂੰ ਆਮ ਬੰਦਾ ਕੋਈ ਨਹੀਂ ਖੇਡ ਸਕਦਾ ਗੱਤਕਾ ਖੇਡਣਾ ਬਹੁਤ ਮੁਸ਼ਕਿਲ ਹੈ ਇਸ ਨੂੰ ਜੋ ਕਿ ਗੁਰੂ ਸਿੱਖ ਹੈ ਬੜੇ ਸੋਹਣੇ ਤਰੀਕੇ ਨਾਲ ਜਨਮ ਦਿਹਾੜੇ 'ਤੇ ਗੁਰਸਿੱਖ ਦੇ ਜਨਮ ਦਿਹਾੜੇ 'ਤੇ ਬੜਾ ਵਧੀਆ ਰੋਲ ਨਿਭਾ ਕੇ ਖੇਡਦੇ ਹਨ ਗੱਤਕਾ ਪੰਜਾਬੀਆਂ ਲਈ ਇੱਕ ਮਨਮੂਲ ਆਰਟ ਹੈ ਜੋ ਕਿ ਪੰਜਾਬੀ ਇਸ ਨੂੰ ਬਹੁਤ ਚਿਰ ਤੋਂ ਮੰਨਦੇ ਆ ਰਹੇ ਹਨ ਕਿ ਗੁਰੂ ਸਿੱਖ ਨਾਲ ਜੁੜੇ ਰਹਿਣ ਗੱਤਕਾ ਖੇਡਣ ਲਈ ਗਰਮੀਆਂ ਵਿੱਚ ਵੀ ਆਮ ਬੱਚੇ ਜਾ ਕੇ ਗੁਰੂ ਗੁਰੂ ਘਰ ਵਿੱਚ ਜਾ ਕੇ ਆਮ ਗੱਤਕਾ ਸਿੱਖਦੇ ਹਨ ਅਤੇ ਖੇਡਦੇ ਹਨ ਗੁਰੂ ਸਿ ਗੱਤਕਾ ਖੇਡਣ ਨਾਲ ਸਰੀਰ ਪੂਰਾ ਫਿਟਨੈਸ ਰਹਿੰਦਾ ਹੈ ਸਰੀਰ ਦੀ ਅਤੇ ਗੱਤਕਾ ਗਰਮੀਆਂ ਵਿੱਚ ਆਮ ਬੱਚੇ ਆਪਣੇ ਗੁਰੂ ਘਰਾਂ ਵਿੱਚ ਜਾ ਕੇ ਗੁਰਸਿੱਖਾਂ ਦੁਆਰਾ ਸਿੱਖਦੇ ਹਨ ਅਤੇ ਕਿਉਂਕਿ ਉਹ ਸਿੱਖੀ ਨਾਲ ਜੁੜ੍ਹੇ ਰਹਿਣ ਇਸ ਲਈ ਜੋ ਸਾਡੇ ਪੰਜਾਬੀ ਇਹ ਘਰਾਂ ਵਾਲੇ ਹੈ ਪੰਜਾਬੀ ਪਰਿਵਾਰਾਂ ਵਾਲੇ ਹੈ ਉਹ ਚਾਹੁੰਦੇ ਹਨ ਕਿ ਸਾਡੇ ਬੱਚੇ ਵੀ ਗੁਰੂ ਸਿੱਖ ਨਾਲ ਜੁੜ੍ਹੇ ਰਹਿਣ